ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਧੀਆ ਹੀ ਚੱਲ ਰਿਹਾ ਅਤੇ ਨਹੀਂ ਵੀ ਚੱਲ ਰਿਹਾ ਮਤਲਬ ਐਦਾਂ ਹੀ ਚੱਲ ਰਿਹਾ ਸਰਿਆ ਹੀ ਕਰਦਾ ਸਾਡਾ ਕੰਮ ਗਰਮੀ ਬਹੁਤ ਹੋਈ ਪਈ ਹੈ ਅਤੇ ਝੋਨਾ ਨਹੀਂ ਲੱਗ ਰਿਹਾ ਬੀਜ ਵੀ ਸੜੀ ਜਾ ਰਹੇ ਨੇ ਹਾਂਜੀ ਕਿੰਨੇ ਦੀ ਜ਼ਮੀਨ ਲਿੱਤੀ ਤੁਸੀਂ ਤੁਹਾਡਾ ਉੱਥੇ ਕੀ ਚੱਲ ਰਿਹਾ ਹਾਂਜੀ ਹਾਂਜੀ

ਹਾਂਜੀ ਗਰਮੀ ਵੀ ਇੰਨੀ ਪੈ ਰਹੀ ਅਤੇ ਪਰਾਲੀਆਂ ਵੀ ਸਾਡੀਆਂ ਸੜ ਗਈਆਂ ਤੇ ਇੰਨਾ ਨੁਕਸਾਨ ਹੋ ਗਿਆ ਸਾਡਾ ਹਾਂਜੀ ਸਾਡੀ ਸਰਕਾਰ ਨੂੰ ਵੀ ਚਾਹੀਦਾ ਕਿ ਸਾਡਾ ਕੋਈ ਹੱਲ ਕਰੇ ਗਲੋਬਲ ਵਾਰਮਿੰਗ ਨੂੰ ਘੱਟ ਕਰੇ ਥੋੜ੍ਹੇ ਕੋਈ ਨਿਯਮ ਬਣਾਏ ਤਾਂ ਕਿ ਲੋਕਾਂ ਨੂੰ ਥੋੜ੍ਹਾ ਪਤਾ ਲੱਗੇ ਕਿਵੇਂ ਇਹਨਾਂ ਨੂੰ ਘੱਟ ਕਰ ਸਕਦੇ ਹਾਂ ਹਾਂਜੀ ਸਹੀ ਗੱਲ ਆ ਉਹਨਾਂ ਨੂੰ ਦੱਸਣਾ ਚਾਹੀਦਾ ਅਗਰ ਅੰਨ ਨਹੀਂ ਉੱਗੇਗਾ ਤਾਂ ਉਹ ਖਾਏਗੇ ਕੀ ਹਾਂਜੀ ਵਿਕਾਸ ਵੀ ਸਾਡੇ ਕਿਸਾਨਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ

ਗਲੋਬਲ ਵਾਰਮਿੰਗ ਨਾਲ ਤਾਂ ਸਾਡੀ ਜਿਹੜੀ ਅਸੀਂ ਪਾਣੀ ਤਾਂ ਪਾਣੀ ਦਾ ਵੀ ਥੋੜ੍ਹਾ ਘਾਟਾ ਹੀ ਹੋਇਆ ਜਮੀਨ ਸੁੱਕੀ ਜਾ ਰਹੀ ਹੈ ਪਾਣੀ ਪਾਣੀ ਦੀ ਕਮੀ ਹੋਈ ਜਾ ਰਹੀ ਆ ਉਹਨਾਂ ਨੂੰ ਫ਼ਸਲਾਂ ਨੂੰ ਵੀ ਅੱਛਾ ਅੱਛਾ ਇਹ ਵੀ ਇੱਕ ਸਮੱਸਿਆ ਦਾ ਕਾਰਨ ਹੀ ਹੈ ਇੰਨੀ ਸਮੱਸਿਆ ਹੋਈਆਂ ਪਈਆਂ ਇਹਨਾਂ ਨੂੰ ਕੋਈ ਹੱਲ ਕਰਨਾ ਚਾਹੀਦਾ ਸਾਡਾ ਚਲੋ ਕੋਈ ਨਹੀਂ ਅਸੀਂ ਰੱਬ ਨੂੰ ਅਰਦਾਸ ਕਰਦੇ ਹਾਂ ਕਿ ਜਿੰਨਾ ਹੋ ਸਕੇ ਜਲਦੀ ਤੋਂ ਜਲਦੀ ਸਾਡੀ ਫ਼ਸਲਾਂ ਦਾ ਕੋਈ ਹੱਲ ਹੋਏ ਹਾਂਜੀ ਚਲੋ ਚੰਗਾ ਜੀ